ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਹੋਰ ਹਾਂਜੀ ਹਾਂਜੀ ਵਧੀਆ ਕੀ ਬਣਦਾ ਫਸਲ ਵਾੜੀ ਦਾ ਅਤੇ ਇਹ ਝੋਨਾ ਨਰਮਾ ਹੁਣ ਛੱਡੋ ਇਹ ਤਾਂ ਮੱਕੀ ਟਰਾਈ ਕਰੋ ਤੁਸੀਂ ਮੱਕੀ ਹਾਂ ਮੈਂ ਦੋ ਸਾਲ ਹੋ ਗਏ ਲਾਉਂਦੇ ਨੂੰ ਮੱਕੀ ਹਾਂ ਪੂਰਾ ਵਧੀਆ ਤਾਂ ਝਾੜ ਹੈ ਨਾਲ ਵਾਹਣ ਵਧੀਆ ਰੈਲਾ ਰਹਿ ਜਾਂਦਾ ਤਿੰਨ ਚਾਰ ਸਾਢੇ ਤਿੰਨ ਮਹੀਨੇ ਫਸਲ ਹੈ ਅਤੇ ਨਾਲ ਝੋਨਾ ਸਾਰਾ ਦਿਨ ਮਗਜ਼ ਮਾਰੀ ਕਰੀ ਜਾਓ ਇਹ ਤੋਂ ਪੂਰਾ ਵਧੀਆ ਇਹ ਹਾਂ ਹਾਂ ਹਾਂ ਹਾਂ ਹਾਂ ਇਹ ਤਾਂ ਹੈ ਇਹ ਤਾਂ ਹੈ ਸਭ ਨਹੀਂ ਮੱਕੀ ਦੀ ਫਸਲ ਤਾਂ ਇੱਕ ਵਾਰੀ ਹੋਊਗੀ ਗੱਲ ਕਰਨ ਨੂੰ ਐਂ ਵੀ ਇਹ ਤਿੰਨ ਕੁ ਮਹੀਨੇ ਸਾਢੇ ਕੁ ਤਿੰਨ ਮਹੀਨਿਆਂ 'ਚ ਤਿਆਰ ਹੋ ਜਾਂਦਾ ਹਾਂ ਵਾਹਣ ਇਹ ਤਾਂ ਵਾਹਣ ਰੈਲਾ ਰਹਿ ਜਾਂਦਾ ਫਿਰ ਗਾਹਾਂ ਕਣਕ ਚੰਗੀ ਹੋ ਜਾਂਦੀ ਆ

ਇਹ ਫਜੈਂਟਾ ਦਾ ਆਉਂਦਾ ਜੀ ਫਜੈਂਟਾ ਦਾ

ਝਾੜ ਬਹੁਤ ਵਧੀਆ ਲੇਵਰ ਦਾ ਕੋਈ ਖਾਸ ਹੈ ਨਹੀਂ ਲੇਵਰ ਤਾਂ ਇਹਦਾ ਬਸ ਛੱਲੀਆਂ ਤੋੜਨ 'ਤੇ ਲਾ ਲਓ ਤੁਸੀਂ ਦਿਹਾੜੀਏ ਦੋ ਦਿਹਾੜੀਏ ਤੋੜ ਦਿੰਦੇ ਛੱਲੀਆਂ ਕਿੱਲੇ ਦੀਆਂ ਹਾਂ ਉਹ ਤੋਂ ਬਾਅਦ ਬਾਕੀ ਵੱਢ ਕੇ ਜਾਨਵਰਾਂ ਨੂੰ ਹਾਂਜੀ ਹਾਂਜੀ ਹਾਂ ਹਾਂ ਠੀਕ ਹੈ ਜੀ ਹਾਂ ਹਾਂ ਹਾਂਜੀ ਹਾਂਜੀ ਓਕੇ ਓਕੇ